ਹੈਲੋ ਸਤਿ ਸ੍ਰੀ ਅਕਾਲ ਵੀਰੇ ਮੇਰਾ ਨਾਮ ਰਾਹੁਲ ਹੈ ਅਤੇ ਮੈਂ ਵੈਕਸੀਨ ਸਰਟੀਫਿਕੇਟ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਸਿਰਫ ਫਿਜੀਕਲ ਕੋਪੀ ਹੈ ਅਤੇ ਮੈਂ ਉਪਲੋਡ ਕਰਨਾ ਚਾਹੁੰਦਾ ਹਾਂ ਇਸ ਸਰਟੀਫਿਕੇਟ ਨੂੰ ਇਸ ਸਰਟੀਫਿਕੇਟ ਦੀ ਮੈਨੂੰ ਜ਼ਿਆਦਾ ਜ਼ਰੂਰਤ ਇਸ ਲਈ ਹੈ ਕਿਉਂਕੀ ਮੈਂ ਬਾਹਰਲੇ ਦੇਸ਼ ਜਾਣਾ ਹੈ ਜਿਸ ਕਰਕੇ ਮੈਨੂੰ ਏਅਰਪੋਰਟ 'ਤੇ ਚੈਕਿੰਗ ਦੌਰਾਨ ਬਾਹਰ ਕੱਢ ਦਿੱਤਾ ਜਾਂਦਾ ਹੈ ਕਿਉਂਕੀ ਮੇਰੇ ਕੋਲ ਡਿਜੀਟਾਈਜ ਵਾਲਾ ਟੀਕਾਕਰਨ ਦਾ ਸਰਟੀਫਿਕੇਟ ਨਹੀਂ ਹੈ ਜਿਸ ਕਰਕੇ ਮੈਨੂੰ ਇਸ ਲਈ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਕੀ ਤੁਸੀਂ ਐਸਾ ਤਰੀਕਾ ਜਾਣਦੇ ਹੋ ਕਿ ਜਿਸ ਨਾਲ ਮੈਂ ਆਪਣੇ ਸਰਟੀਫਿਕੇਟ ਨੂੰ ਡਿਜੀਟਾਈਜ ਕਰ ਸਕਾਂ ਇਸ ਵਿੱਚ ਮੈਨੂੰ ਆਪਣੇ ਮੋਬਾਈਲ ਨੰਬਰ ਜਾਂ ਕੁਛ ਹੋਰ ਦੀ ਜ਼ਰੂਰਤ ਤਾਂ ਨਹੀਂ ਜਾਂ ਕੋਈ ਪਰੂਫ ਆਧਾਰ ਆਈਡੀ ਜਾਂ ਪੈਨ ਕਾਰਡ ਇਸ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਜੇਕਰ ਇਸ ਦੀ ਕੋਈ ਫੀਸ ਹੈ ਤਾਂ ਮੈਨੂੰ ਉਸ ਬਾਰੇ ਵੀ ਦੱਸ ਦਿੱਤਾ ਜਾਵੇ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਲਈ ਕਰ ਰਿਹਾ ਹਾਂ ਕਿਉਂਕੀ ਮੈਨੂੰ ਜਲਦੀ ਤੋਂ ਜਲਦੀ ਸਰਟੀਫਿਕੇਟ ਦੀ ਜ਼ਰੂਰਤ ਹੈ ਜੇਕਰ ਤੁਸੀਂ ਮੇਰਾ ਕੰਮ ਕਰਦੇ ਹੋ ਤਾਂ ਮੇਰਾ ਕੰਮ ਬਹੁਤ ਜ਼ਿਆਦਾ ਅਸਾਨ ਹੋ ਸਕਦਾ ਹੈ ਮੈਂ ਤੁਹਾਡਾ ਅਤਿ ਧੰਨਵਾਦੀ ਹੋਵਾਂਗਾ ਤੁਹਾਡਾ ਸ਼ੁਕਰੀਆ ਤੁਸੀਂ ਮੇਰੀ ਇੰਨੀ ਮਦਦ ਕੀਤੀ ਕਿਰਪਾ ਕਰਕੇ ਮੈਨੂੰ ਜਲਦ ਤੋਂ ਜਲਦ ਦੱਸ ਦਿੱਤਾ ਜਾਵੇ ਇਸ ਬਾਰੇ ਵੀ ਦੱਸ ਦਿੱਤਾ ਜਾਵੇ ਕਿ ਇਸ ਵਿੱਚ ਕਿੰਨਾ ਟਾਈਮ ਲੱਗ ਸਕਦਾ ਹੈ ਅਤੇ ਇਸ ਨੂੰ ਡਿਜੀਟਾਈਜ ਕਰਨ ਤੋਂ ਬਾਅਦ ਮੈਨੂੰ ਆਪਣੇ ਫਿਜੀਕਲ ਸਰਟੀਫਿਕੇਟ ਦੀ ਜ਼ਰੂਰਤ ਹੈ ਜਾਂ ਨਹੀਂ ਭੌਤਿਕ ਕਾਪੀ ਦੇ ਕੰਮ ਕਰਨ ਨਾਲ ਜ਼ਿਆਦਾ ਜ਼ਰੂਰਤ ਨਹੀਂ ਹੈ ਪਰ ਮੇਰੇ ਕੋਲ ਸਕੈਨਰ ਦੀ ਪਹੁੰਚ ਨਹੀਂ ਹੈ ਇਸ ਲਈ ਮੈਨੂੰ ਸਰਟੀਫਿਕੇਟ ਦੀ ਡਿਜੀਟਾਈਜ ਕੋਪੀ ਦੀ ਜ਼ਰੂਰਤ ਹੈ